ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਮੈਂ ਤੁਹਾਡਾ ਨੰਬਰ ਨਾ ਤੁਹਾਡੇ ਪੜੋਸ ਤੋਂ ਲਿਆ ਅਤੇ ਅਸੀਂ ਨਵੇਂ ਨਵੇਂ ਇੱਥੇ ਸਿਫਟ ਹੋਏ ਹਾਂ ਅਤੇ ਸਾਨੂੰ ਪਾਣੀ ਦੀ ਬੜੀ ਦਿੱਕਤ ਆਇਆ ਕਰਦੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿ ਮਤਲਬ ਕਿ ਇੱਥੇ ਪਾਣੀ ਦਾ ਕੀ ਪ੍ਰੋਸੀਜਰ ਹੈ ਕਿ ਪਾਣੀ ਕਿਸ ਵੇਲੇ ਆਉਂਦਾ ਅਤੇ ਜੋ ਵੀ ਦੱਸੋ ਸਾਨੂੰ ਪਾਣੀ ਦੇ ਬਾਰੇ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਅਤੇ ਇਸ ਹੁਣ ਟਾਈਮਿੰਗ ਹੈ ਹਾਲੇ ਪਾਣੀ ਦੀ ਨਹੀਂ ਹੈ ਇੱਥੇ ਦਾ ਮਤਲਬ ਕਿ ਪਾਣੀ ਕਿੱਥੋਂ ਮਿਲੇਗਾ ਇਸ ਵੇਲੇ ਸਾਨੂੰ ਫਿਲਹਾਲ ਹਾਂਜੀ

ਹਾਂਜੀ ਹਾਂਜੀ ਫਿਰ ਸ਼ਾਮ ਨੂੰ ਪਾਣੀ ਆ ਜਾਵੇਗਾ ਫਿਰ ਅਸੀਂ ਉਹ ਯੁਜ ਕਰ ਲਾਂਗੇ ਠੀਕ ਹੈ ਸਰ ਥੈਂਕ ਯੂ